ਹਾਂਜੀ ਮੁਬਾਰਕਾਂ ਜੀ ਤੁਹਾਡੇ ਬੱਚੇ ਦੀਆਂ ਅਤੇ ਮੈਂ ਪੁੱਛਣਾ ਸੀਗਾ ਕਿ ਜੇ ਤੁਸੀਂ ਆਪਣੇ ਰਜਿਸਟਰੇਸ਼ਨ ਕਰਵਾਣੀ ਹੈਗੀ ਬੱਚੇ ਦੇ ਨਾਂ ਦੀ ਤਾਂ ਉਹਦਾ ਜਿਹੜਾ ਨੰਬਰ ਹੈਗਾ ਉਹ ਮੈਨੂੰ ਸੈਂਡ ਕਰ ਦਿਓ ਅਤੇ ਮੈਂ ਵਾਰ ਵਾਰ ਜਿੱਦਾਂ ਇੱਕ ਵਾਰ ਆਪਾਂ ਰਜਿਸਟਰਡ ਕਰ ਲੈਂਦੇ ਹਾਂ ਫਿਰ ਜਦੋਂ ਵੀ ਆਪਾਂ ਹਫ਼ਤੇ ਦੋ ਹਫ਼ਤੇ ਵਿੱਚ ਜਿਹੜੀ ਡਾਕੂਮੈਂਟ ਆਪਾਂ ਸਬਮਿਟ ਕਰਵਾਉਣੇ ਸੁਵਿਧਾ ਕੇਂਦਰ ਦੇ ਵਿੱਚ ਤਾਂ ਉੱਥੇ ਜਾ ਕੇ ਆਪਾਂ ਸਮਾਂ ਸਬਮਿਟ ਕਰਵਾ ਦਾਂਗੇ ਅਤੇ ਬਾ ਨ ਉਸ ਤੋਂ ਬਾਅਦ ਮੈਂ ਉਹਦੇ ਫੋਲੋ ਅਪ ਕਰ ਲੂੰਗਾ ਕਿ ਵੀ ਕਿੰਨਾ ਕੁ ਟਾਈਮ ਹੋਰ ਲੱਗਣਾ ਕਿ ਨਹੀਂ ਲੱਗਣਾ ਕਿਉਂਕਿ ਆਹ ਚੀਜ਼ਾਂ ਨਾ ਜਿੱਦਣ ਤੋਂ ਹਫ਼ਤੇ ਦੋ ਕੁ ਹਫ਼ਤੇ ਤੋਂ ਮਤਲਬ ਹਫ਼ਤੇ ਦੋ ਹਫ਼ਤੇ ਤੱਕ ਆ ਨਾਮ ਚੜ ਜਾਣਾ ਚਾਹੀਦਾ ਤਾਂ ਅੱਗੇ ਜਾ ਕੇ ਨਾ ਕਾਫ਼ੀ ਦਿੱਕਤ ਆਉਂਦੀ ਹੈ ਇਸ ਕਰਕੇ ਜੇ ਤੁਸੀਂ ਉਹ ਦੇ ਦੋ ਮੈਨੂੰ ਨੰਬਰ ਰਜਿਸਟ੍ਰੇਸ਼ਨ ਨੰਬਰ ਹੈਗਾ ਜਿਹੜਾ ਤੁਸੀਂ ਇਹ ਆਪਣੇ ਹਸਪਤਾਲ 'ਤੇ ਲਿਖਾਇਆ ਹੋਵੇਗਾ ਹਸਪਤਾਲ ਦੀ ਕੋਪੀ ਜਨਮ ਦਿ ਦਿਨ ਦਾ ਅਤੇ ਡੇਟ ਦਾ ਜਿਹੜਾ ਬਰਥ ਸਰਟੀਫਿਕੇਟ ਜਿਹੜਾ ਬਣਨਾ ਹੈਗਾ ਹੈ ਉਹਦੇ 'ਤੇ ਜਿਹੜਾ ਨੰਬਰ ਹੈਗੇ ਹੈ ਉਹ ਫਰਾਈਡੇ ਕਰਵਾ ਦਿਓ ਮੈਂ ਕਰਵਾ ਦਾਂਗਾ